ਰੋਪੜ ਜ਼ਿਲ੍ਹੇ ਤੋਂ ਅੱਗੇ ਜਿਹੜਾ ਨਵਾਂਸ਼ਹਿਰ ਜ਼ਿਲ੍ਹਾ ਹੈ ਉਹ ਪੈਂਦਾ ਹੈ ਅਤੇ ਜੇ ਇੱਥੇ ਦੀ ਗੱਲ ਕਰੀਏ ਇੱਥੇ ਦੀ ਆਰਥਿਕ ਸਥਿਤੀ ਹੈ ਤਾਂ ਇੱਥੇ ਦੇ ਜਿਹੜੇ ਜ਼ਿਆਦਾਤਰ ਲੋਕ ਨੇ ਉਹ ਖੇਤੀਬਾੜੀ ਦੇ ਉੱਤੇ ਹੀ ਨਿਰਭਰ ਕਰਦੇ ਹਨ ਉਹਨਾਂ ਇੱਥੇ ਦਾ ਜਿਹੜਾ ਮੇਨ ਕਿੱਤਾ ਹੈ ਉਹ ਖੇਤੀਬਾੜੀ ਹੀ ਹੈ ਇੱਥੇ ਬਹੁਤ ਸਾਰੀਆਂ ਫੈਕਟਰੀਆਂ ਵੀ ਹੈ ਜਿਹੜੀਆਂ ਕਿ ਬਣੀਆਂ ਹੋਈਆਂ ਨੇ ਪਰ ਫੈਕਟਰੀਆਂ ਦੇ ਵਿੱਚ ਜਿਹੜੇ ਜ਼ਿਆਦਾਤਰ ਪਰਦੇਸੀ ਜਿਹੜੇ ਕਿ ਬਈਏ ਜਿਹੜੇ ਹੋਰ ਰਾਜ ਤੋਂ ਆ ਕੇ ਬੰਦੇ ਨੌਕਰੀਆਂ ਕਰ ਰਹੇ ਹਨ ਅਤੇ ਜਿਹੜੇ ਇੱਥੇ ਦੇ ਯੂਥ ਹੈ ਜਿਹੜਾ ਇੱਥੇ ਦਾ ਨੌਜਵਾਨ ਪੀੜੀ ਹੈ ਉਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲ ਪਾ ਰਹੀਆਂ ਜਿਸ ਕਰਕੇ ਉਹਨਾਂ ਦੇ ਕੋਲ ਜਿਹੜੀ ਆਖਰੀ ਇੱਕ ਬਚਦੀ ਹੈ ਜਿਹੜਾ ਉਹਨਾਂ ਕੋਲ ਆਖਰੀ ਇੱਕ ਤਰੀਕਾ ਬਚਦਾ ਹੈ ਰੋਜ਼ੀ ਰੋਟੀ ਕਮਾਉਣ ਦਾ ਉਹ ਇਹ ਹੈ ਕਿ ਬੱਚੇ ਸਾਰੇ ਬਾਹਰ ਨੂੰ ਜਾ ਰਹੇ ਹਨ ਅਤੇ ਇਸ ਕਰਕੇ ਜਿਹੜੇ ਨਵਾਂਸ਼ਹਿਰ ਦੇ ਵਿੱਚ ਬਾਹਰ ਜਾਣ ਦੀ ਜਿਹੜੀ ਦੌੜ ਹੈ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਲੱਗੀ ਹੋਈ ਹੈ ਪਰ ਅਗਰ ਜੇਕਰ ਇਸ ਦੀ ਸਮਾਜਿਕ ਸਥਿਤੀ ਦੀ ਗੱਲ ਕਰੀਏ ਤਾਂ ਜਿਹੜੇ ਨਵਾਂਸ਼ਹਿਰ ਜ਼ਿਲ੍ਹੇ ਦੇ ਲੋਕ ਨੇ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਹਨ ਉਹ ਮ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਿਹੜੀ ਇੱਕ ਦੂਸਰੇ ਦੀ ਮਦਦ ਹੈ ਜਿਹੜੀ ਕਰਦੇ ਹਨ ਅਤੇ ਪੰਜਾਬ ਦੇ ਵਿੱਚ ਜਿਹੜਾ ਕਿ ਜੋਇੰਟ ਫੈਮਿਲੀ ਦਾ ਸਿਸਟਮ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਪਰ ਨਵਾਂਸ਼ਹਿਰ ਦੇ ਵਿੱਚ ਅੱਜ ਵੀ ਤੁਸੀਂ ਜਿਹੜਾ ਇਹ ਜੋਇੰਟ ਫੈਮਲੀ ਵਾਲਾ ਕੰਨਸੈਪਟ ਹੈ ਤੁਸੀਂ ਇਹ ਦੇਖ ਸਕਦੇ ਹੋ ਵੱਡੇ ਵੱਡੇ ਪਰਿਵਾਰ ਹੈ ਜਿਹੜੇ ਇੱਕ ਛੱਤ ਦੇ ਥੱਲੇ ਰਹਿ ਰਹੇ ਨੇ ਅਤੇ ਜੇਕਰ ਅਸੀਂ ਗੱਲ ਕਰੀਏ ਇਸ ਦੇ ਵਾਤਾਵਰਨ ਦੀ ਤਾਂ ਇੱਥੇ ਦਾ ਜਿਹੜਾ ਵਾਤਾਵਰਨ ਹੈ ਬਹੁਤ ਹੀ ਸ਼ੁੱਧ ਹੈ ਕਿਉਂਕਿ ਜਿਹੜੇ ਖੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਖੇਤੀਬਾੜੀ ਦੇ ਵਿੱਚ ਹਨ ਤਾਂ ਇੱਥੇ ਜਿਹੜੇ ਖੇਤ ਹੈ ਇੱਥੇ ਦੇ ਜਿਹੜਾ ਵਾਤਾਵਰਨ ਹੈ ਉਸਨੂੰ ਸਾਫ ਰੱਖਦੇ ਹਨ ਅਤੇ ਇੱਥੇ ਸਤਲੁਜ ਦਰਿਆ ਵੀ ਹੈ ਜਿਹੜਾ ਕਿ ਇਹਦੇ ਕੰਢੇ ਪੈਂਦਾ ਹੈ ਜਿਸ ਕਰਕੇ ਸਤਲੁਜ ਦਰਿਆ ਕਰਕੇ ਨਹਿਰਾਂ ਕਰਕੇ ਜਿਹੜਾ ਇੱਥੇ ਦਾ ਵਾਤਾਵਰਨ ਹੈ ਉਹ ਬਹੁਤ ਹੀ ਮਨਮੋਹਕ ਸ਼ੁੱਧ ਹੈ ਜਿਹੜਾ ਬਣ ਜਾਂਦਾ ਹੈ ਅਤੇ ਜੇਕਰ ਗੱਲ ਕਰੀਏ ਰਾਜਨੀਤਿਕ ਤੌਰ 'ਤੇ ਤਾਂ ਜਿਹੜਾ ਨਵਾਂਸ਼ਹਿਰ ਹੈ ਉਹ ਰਾਜਨੀਤਿਕ ਤੌਰ 'ਤੇ ਹਲੇ ਵੀ ਬਹੁਤ ਪਿੱਛੇ ਚੱਲ ਰਿਹਾ ਹੈ ਕਿਉਂਕਿ ਅਸੀਂ ਜਿਵੇਂ ਹੀ ਜਿੱਦਾਂ ਕਿ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਸਾਡੇ ਇੱਧਰ ਦੇ ਬੱਚੇ ਨੇ ਉਹ ਬਾਹਰ ਜਾ ਰਹੇ ਨੇ ਜਿਸਦਾ ਇਹ ਇਹ ਮੁੱਖ ਕਾਰਨ ਇਹ ਹੈ ਕਿ ਜਿਹੜੇ ਇੱਥੇ ਦੇ ਨੇਤਾ ਨੇ ਉਹ ਸਿਰਫ ਆਪਣੀਆਂ ਹੀ ਝੋਲੀਆਂ ਭਰ ਰਹੇ ਹਨ ਉਹ ਵਾਅਦੇ ਕਰਕੇ ਲੋਕਾਂ ਦੇ ਨਾਲ਼ ਮੁੱਕਰ ਜਾਂਦੇ ਹਨ ਉਹ ਲੋਕਾਂ ਦੀ ਬਿਹਤਰ ਜ਼ਿੰਦਗੀ ਬਿਹਤਰ ਕਰਨ ਦੇ ਲਈ ਕੁਛ ਨਹੀਂ ਕਰ ਰਹੇ ਉਹ ਸਿਰਫ ਔਰ ਸਿਰਫ ਆਪਣਾ ਹੀ ਜਿਹੜਾ ਕਿ ਘਰ ਹੈ ਉਹ ਭਰ ਰਹੇ ਹਨ ਅਤੇ ਬੱਚੇ ਹੈ ਜਿਹੜੇ ਆਪਣਾ ਉਹਨਾਂ ਦਾ ਇੱਥੇ ਬਰੇਨ ਡਰੇਨ ਵਾਲਾ ਕੰਮ ਹੋ ਰਿਹਾ ਹੈ ਅਤੇ ਮਤਲਬ ਐਜੂਕੇਸ਼ਨ ਉਹ ਇੱਥੋਂ ਲੈ ਰਹੇ ਨੇ ਅਤੇ ਬਾਹਰ ਪੰਦਰਾਂ ਵੀਹ ਲੱਖ ਰੁਪਏ ਬਾਹਰ ਜਾ ਕੇ ਲਗਾ ਕੇ ਉਹ ਸਾਰੇ ਇੰਟਰਨੈਸ਼ਨਲ ਕੰਪਨੀਜ਼ ਨੂੰ ਜਾਂ ਉੱਧਰ ਏਜੰਸੀਸ ਨੂੰ ਉਹ ਵਾਲਾ ਸਾਰਾ ਹੈ ਜਿਹੜਾ ਪੈਸਾ ਚਲੇ ਜਾਂਦਾ ਹੈ ਤਾਂ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਇੱਥੇ ਸਾਡੇ ਸਮਾਜ ਦੇ ਬਾਰੇ ਕੁਛ ਨਹੀਂ ਸੋਚਦੇ ਅਤੇ ਉਹ ਸਿਰਫ ਔਰ ਸਿਰਫ ਆਪਣਾ ਹੀ ਘਰ ਹੈ ਜੋ ਆਪਣੀਆਂ ਝੋਲੀਆਂ ਭਰ ਰਹੇ ਹਨ